ਅੱਠ ਅਕਤੂਬਰ ਉੱਨੀ ਸੌ ਉਨਾਨਵੇਂ ਇੱਕੀ ਫਰਵਰੀ ਉੱਨੀ ਸੌ ਨੱਬੇ ਚੌਦਾਂ ਜਨਵਰੀ ਦੋ ਹਜ਼ਾਰ ਦੋ ਬਾਰਾਂ ਮਾਰਚ ਦੋ ਹਜ਼ਾਰ ਬਾਈ ਸਤਾਈ ਅਪ੍ਰੈਲ ਦੋ ਹਜ਼ਾਰ ਤੇਈ